ਔਰਤਾਂ ਲਈ ਇੱਕ ਸ਼ੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਔਰਤਾਂ ਆਪਣੇ ਮੁੱਦਿਆਂ 'ਤੇ ਗੱਲ ਕਰ ਸਕਣ ਔਰਤਾਂ ਨੂੰ ਜਿਵੇਂ ਕਿ ਘਰ ਦੇ ਕੰਮਾਂ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਆਪਣੀਆਂ ਦਿੱਕਤਾਂ ਅਤੇ ਪਰੇਸ਼ਾਨੀਆਂ ਨੂੰ ਰੱਖ ਸਕਣ ਜਿਵੇਂ ਕਿ ਅਖ਼ਬਾਰ ਦੇ ਵਿੱਚ ਕੋਲਮ ਹੋਣਾ ਚਾਹੀਦਾ ਹੈ ਜਿਵੇਂ ਕਿ ਰੇਡੀਓ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਔਰਤ ਆਪਣੀਆਂ ਸਮੱਸਿਆਵਾਂ ਨੂੰ ਦੱਸ ਸਕਣ ਅਤੇ ਘਰੇਲੂ ਔਰਤਾਂ ਨੂੰ ਜ਼ਿਆਦਾ ਦਿੱਕਤ ਅਤੇ ਪਰੇਸ਼ਾਨੀਆਂ ਨਾ ਝੱਲਣੀਆਂ ਪੈਣ ਅਤੇ ਉਹਨਾਂ ਨੂੰ ਜੋ ਵੀ ਦਿੱਕਤਾਂ ਆਉਂਦੀਆਂ ਹਨ ਅਤੇ ਉਸ ਚੀਜ਼ ਦਾ ਉਹ ਹੱਲ ਕਰ ਸਕਣ